ਭਾਰਤ ਵਿੱਚ ਸਭ ਤੋਂ ਮਨ ਮਨਪਸੰਦ ਰਾਜ ਜਿਹੜਾ ਹੈ ਉਹ ਹੈ ਉੱਤਰਾਖੰਡ ਕਿਉਂਕਿ ਇੱਥੇ ਕਾਫੀ ਸਾਰੇ ਹਿਲ ਸਟੇਸ਼ਨ ਹਨ ਜਿਸ ਮੈਨੂੰ ਪਹਾੜਾਂ 'ਤੇ ਘੁੰਮਣਾ ਬਹੁਤ ਜ਼ਿਆਦਾ ਪਸੰਦ ਹੈ ਅਤੇ ਉੱਥੇ ਕਾਫੀ ਸਾਰੇ ਹਿਲ ਸਟੇਸ਼ਨ ਹਨ ਦੇਹਰਾਦੂਨ ਦੇ ਨੇੜੇ ਇੱਕ ਹਿਲ ਸਟੇਸ਼ਨ ਹੈ ਜਿਸ ਦਾ ਨਾਮ ਮਸੂਰੀ ਹੈ ਇਹ ਆਪਣੇ ਆਪ ਵਿੱਚ ਕਾਫੀ ਪ੍ਰਸਿੱਧ ਹੈ ਅਤੇ ਇੱਥੇ ਬਹੁਤ ਸਾਰੇ ਲੋਕ ਘੁੰਮਣ ਲਈ ਆਉਂਦੇ ਹਨ